ਸਾਡੇ ਖੇਤਰ ਵਿੱਚ ਧਰਮ ਨਾਲ ਸੰਬੰਧਿਤ ਵਾਦ ਜਾਂ ਵਿਵਾਦਪੂਰਨ ਮੁੱਦਿਆਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਵਿੱਚੋਂ ਸਿੱਖ ਧਰਮ ਵਿੱਚ ਮਾਸ ਖਾਣਾ ਕੀ ਜਾਇਜ਼ ਹੈ ਜਾਂ ਨਾਜਾਇਜ਼ ਇਸ ਬਾਰੇ ਬੜੀ ਬਹਿਸ ਚੱਲਦੀ ਹੈ ਜਿਹੜੇ ਲੋਕ ਮਾਸ ਨਹੀਂ ਖਾਂਦੇ ਉਹ ਇਸ ਨੂੰ ਗਲਤ ਸਿੱਧ ਕਰਦੇ ਹਨ ਕਿ ਮਾਸ ਨਹੀਂ ਖਾਣਾ ਚਾਹੀਦਾ ਜਿਹੜੇ ਖਾਂਦੇ ਹਨ ਉਹ ਕਹਿੰਦੇ ਹਨ ਕਿ ਇਹ ਸਾਡੀਆਂ ਰਵਾਇਤਾਂ ਵਿੱਚ ਸ਼ਾਮਿਲ ਹੈ ਮੁੱਖ ਕਾਰਨ ਇਹ ਹੈ ਕਿ ਸਿੱਖ ਧਰਮ ਇੱਕ ਜੁਝਾਰੂ ਧਰਮ ਹੈ ਔਰ ਇਹ ਜੰਗੀ ਯੋਧਿਆਂ ਵਾਲਾ ਧਰਮ ਰਿਹਾ ਹੈ ਔਰ ਜਦੋਂ ਉਹ ਜੰਗ ਦੇ ਵਿੱਚ ਕੰਮ ਕਰਦੇ ਸਨ ਤਾਂ ਉਹ ਕਈ ਤਰ੍ਹਾਂ ਦੀਆਂ ਉਹਨਾਂ ਦੀਆਂ ਆਪਣੀਆਂ ਰਵਾਇਤਾਂ ਬਣ ਗਈਆਂ ਜਿਹਨਾਂ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਜੋ ਹਨ ਉਹ ਝਟਕਾ ਮਾਸ ਛੱਕਦੀਆਂ ਹਨ ਅਤੇ ਬਾਕੀ ਜਿਹੜੀਆਂ ਦੂਸਰੀਆਂ ਸੰਤ ਪਰੰਪਰਾਵਾਂ ਦੇ ਨਾਲ ਸੰਬੰਧਿਤ ਹਨ ਉਹ ਇਸ ਚੀਜ਼ ਦਾ ਡਾਢਾ ਵਿਰੋਧ ਕਰਦੀਆਂ ਹਨ ਕਿ ਮਾਸ ਖਾਣਾ ਸਿੱਖ ਧਰਮ ਦੇ ਅਨੁਸਾਰ ਠੀਕ ਨਹੀਂ ਹੈ ਔਰ ਇਸ ਤਰ੍ਹਾਂ ਦਾ ਹੀ ਏ ਵਾਦ ਜਿਹੜਾ ਹੈ ਉਹ ਚੱਲਦਾ ਹੈ ਅਤੇ ਇਸ ਨੂੰ ਜੇ ਅਸੀਂ ਅੱਜ ਦੇ ਸਮੇਂ ਵਿੱਚ ਵੀ ਵੇਖੀਏ ਵੀ ਕੀ ਲੋੜ ਹੈ ਅਤੇ ਆਮ ਜੋ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਫੂਡ ਜਾਂ ਭੋਜਨ ਜੋ ਹੈ ਉਹ ਮਿਲ ਰਿਹਾ ਹੈ ਸ਼ਾਕਾਹਾਰੀ ਅਤੇ ਇਹਨਾਂ ਨੂੰ ਕੋਈ ਮਾਸ ਦੀ ਉਸ ਤਰੀਕੇ ਨਾਲ ਲੋੜ ਨਾ ਹੋਣ ਕਰਕੇ ਬਹੁਤੇ ਲੋਕ ਇਹ ਸੋਚਦੇ ਹਨ ਕਿ ਸਾਨੂੰ ਸ਼ਾਕਾਹਾਰੀ ਵੀ ਹੋਣਾ ਚਾਹੀਦਾ ਹੈ